ਮੈਨੂੰ ਪੰਛੀਆਂ ਤੋਂ ਬਹੁ ਮੋਹ ਹੈ ਮੈਂ ਇਹਨਾਂ ਨੂੰ ਆਪਣੇ ਆਕਰਸ਼ਿਤ ਕਰਨ ਲਈ ਇਹਨਾਂ ਲਈ ਮੈਂ ਪਾਣੀ ਔਰ ਦਾਣੇ ਕਣਕ ਕੁਝ ਵੀ ਰੋਟੀਆਂ ਦੇ ਟੁਕੜੇ ਆਪਣੇ ਕੋਠੇ 'ਤੇ ਵਿਹੜੇ 'ਤੇ ਪਾ ਦਿੰਦੀ ਆ ਜਦੋਂ ਵੀ ਇਹ ਆਉਂਦੇ ਆ ਉਹਨਾਂ ਨੂੰ ਚੁਗਦੇ ਆ ਅਤੇ ਇਹਨਾਂ ਨੂੰ ਮੈਂ ਦੇਖਦੀ ਹੈ ਅਤੇ ਬਹੁਤ ਖੁਸ਼ ਹੁੰਦੀ ਹੈ ਇਹਨਾਂ ਦੀਆਂ ਵੀਡੀਓ ਬਣਾਉਂਦੀ ਆ ਅਤੇ ਮੈਨੂੰ ਜੇ ਮੈਨੂੰ ਮੈਂ ਸਾਡੇ ਪਿੰਡ ਵਿੱਚ ਜਿਵੇਂ ਕੀ ਬਾਂਦਰਸ ਵਗੈਰਾ ਕਾਫੀ ਹੈ ਅਤੇ ਗਾਹ ਹੋ ਗਏ ਡੋਗੀ ਹੋ ਗਏ ਇਹਨਾਂ ਨੂੰ ਵੀ ਮੈਂ ਰੋਟੀ ਵਗੈਰਾ ਪਾ ਦਿੰਦੀ ਆ ਅਤੇ ਅਤੇ ਇੱਥੇ ਸਾਡੇ ਪੰਜਾਬ ਵਿੱਚ ਕਾਫੀ ਇੱਦਾਂ ਦਾ ਹੋ ਗਿਆ ਏ ਕਿ ਲੋਕ ਪੰਛੀਆਂ ਨੂੰ ਕੈਦ ਕਰਦੇ ਹਨ ਇਹਨਾਂ ਨੂੰ ਮਤਲਬ ਕਿ ਵੇਚਦੇ ਵੀ ਹਨ ਕਈ ਮਾਰ ਕੇ ਖਾਂਦੇ ਵੀ ਹਨ ਤਾਂ ਕਿ ਸਾਨੂੰ ਇੱਦਾਂ ਦਾ ਨਹੀਂ ਕਰਨਾ ਚਾਹੀਦਾ ਇਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ ਹੈਗਾ ਏ ਇਹਨਾਂ ਨੂੰ ਰੋਕਣਾ ਚਾਹੀਦਾ ਹੈਗਾ ਏ ਤਾਂ ਕਿ ਸਾਨੂੰ ਪੰਛੀਆਂ ਵੀ ਘੱਟ ਹੁੰਦੀਆਂ ਹਨ ਇਹਨਾਂ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕੀ ਪੰਛੀਆਂ ਦਾ ਬਚਾਅ ਹੋਵੇ ਇਹ ਵੀ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜੀਅ ਸਕਣ